ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਤੁਸੀਂ ਸਮਾਈਲ ਫੋਟੋਗਰਾਫਰ ਵਾਲੇ ਬੋਲ ਰਹੇ ਹੋ ਹਾਜੀ ਅਸੀਂ ਤੁਹਾਡਾ ਨਾਮ ਤਾਂ ਬਹੁਤ ਸੁਣਿਆ ਲੇਕਿਨ ਹੁਣ ਕੰਮ ਕਰਾਵਾਂਗੇ ਤਾਂ ਪਤਾ ਚੱਲੇਗਾ ਕੀ ਹੋਇਆ ਐਕਚੁਲੀ ਫਿਰ ਇਹਨੂੰ ਭੈਣ ਦਾ ਮੈਰਿਜ ਹੈ ਉਹਨਾਂ ਦੇ ਅਸੀਂ ਆਹੀ ਚਾਨੇ ਆ ਕਿ ਸਾਡੇ ਸਾਰੇ ਹੀ ਫੰਕਸ਼ਨ ਆ ਤੁਹਾਡੇ ਤੋਂ ਕੰਮ ਕਰਵਾਈਏ ਕਿਉਂਕਿ ਬੋਲ ਲੋਗਾ ਤਾਂ ਉਹ ਵੀ ਤੁਹਾਡ ਫੰਕਸ਼ਨ ਹੈ ਉਹਨਾਂ ਦੀ ਵਿਆਹ ਉਨਦਾ ਦਸ ਤਰੀਕ ਦਾ ਉਸ ਤੋਂ ਪਹਿਲੇ ਸਾਰੇ ਲੇਡੀ ਸੰਗੀਤ ਹਲਦੀ ਦਾ ਪ੍ਰੀਵੈਡਿੰਗ ਦਾ ਸਭ ਤੁਹਾਡੇ ਤੋਂ ਹੀ ਕਰਵਾਨਾ ਅਸੀਂ ਪ੍ਰੀ ਵੈਡਿੰਗ ਚਾਰ ਤਰੀਕ ਨੂੰ ਹੋਏਗੀ ਉਹਨਾਂ ਦੀ ਉਸ ਤੋਂ ਬਾਅਦ ਸੱਤ ਤਰੀਕ ਨੂੰ ਮਹਿੰਦੀ ਲੇਡੀ ਸੰਗੀਤ ਵਗੈਰਾ ਤੇ ਗਿਆਰਾਂ ਨੂੰ ਰਿਸੈਪਸ਼ਨ ਦਾ ਵੀ ਰਿਸੈਪਸ਼ਨ ਦਾ ਵੀ ਤੁਹਾਡੀ ਤੁਸੀਂ ਕਰਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕਿ ਜੀ ਤੁਹਾਡੇ ਹੈਗੇ ਆ ਇਹਨਾਂ ਦੇ ਚਾਰਜਸ ਵਗੈਰਾ ਸਾਡੇ ਪੂਰੇ ਫੁੱਲ ਕੰਪਲੀਟ ਫੰਕਸ਼ਨ ਦੇ ਕੀ ਚਾਰਜਿਸ ਵਗੈਰਾ ਲੈਂਦੇ ਤੁਸੀਂ ਅੱਛਾ ਜੀ ਲੇਕਿਨ ਸਾਨੂੰ ਕੰਮ ਪੂਰਾ ਵਧੀਆ ਚਾਹੀਦਾ ਪੈਸੇ ਦੀ ਕੋਈ ਦਿੱਕਤ ਨਹੀਂ ਹੈ ਪੂਰਾ ਅੱਛਾ ਸਾਰੀ ਬੈਕਗਰਾਊਂਡ ਵਗੈਰਾ ਸਭ ਅੱਛਾ

ਅੱਛਾ ਨਹੀਂ ਨਹੀਂ ਉਹ ਤਾਂ ਅਸੀਂ ਦੇਖ ਕੇ ਹੀ ਆਏ ਆਂ ਬਹੁਤ ਸਾਰੇ ਸਲੈਕਟ ਕੀਤੇ ਆ ਲੇਕਿਨ ਤੁਹਾਡਾ ਕੰਮ ਅੱਛਾ ਲੱਗਿਆ ਅੱਛਾ ਵੀਡੀਓ ਵਗੈਰਾ ਤੁਹਾਡੀ ਐਚਡੀ ਹੁੰਦੀ ਹ ਹਾਂਜੀ ਬਸ ਕੋਈ ਕਿਸੀ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ ਕੋਈ ਕੰਪਲੇਨ ਨਹੀਂ ਆਣੀ ਚਾਹੀਦੀ ਕਿ ਇਹਦੇ ਵਿੱਚ ਕੋਈ ਵੀ ਕਿਉਂਕੀ ਐ ਮੌਕਾ ਵਾਰ ਵਾਰ ਨਹੀਂ ਹੁੰਦਾ ਇਕ ਏ ਵਾਰ ਰਿਕਾਰਡ ਹੋਣਾ ਓਕੇ ਅੱਛਾ ਅੱਛਾ ਜੀ ਔਰ ਫੰਕਸ਼ਨ ਦੇ ਵਿੱਚ ਸਾਨੂੰ ਸੈਲਫੀ ਚੈਨਲ ਵਗੈਰਾ ਵੀ ਚਾਹੀਦੇ ਆ ਸੈਲਫੀ ਵੀਡੀਓਜ ਵਗੈਰਾ ਉਹ ਸਭ ਉੱਪਰ ਠੀਕ ਐ ਜੀ ਅਸੀਂ ਤੁਹਾਡੀ ਦੁਕਾਨ ਤੇ ਮਿਲ ਕੇ ਡਿਜ਼ਾਇਨ ਵਗੈਰਾ ਤੁਹਾਡੇ ਕੋਲ ਹੁੰਦੀ ਹੋਣਗੇ ਤ੍ਡਿ ਜ਼ਾਇਨ ਦੇਖ ਲਾਂਗੇ ਸਲੈਕਟ ਕਰ ਲਾਂਗੇ ਅੱਛਾ ਚਲੋ ਜਿੰਨਾ ਜਿਆਦਾ ਹੋ ਸਕੇ ਡਿਸਕਾਊਂਟ ਦੇਣ ਦੀ ਕੋਸ਼ਿਸ਼ ਕਰਨਾ ਹੋਰ ਵਧੀਆ ਤੋਂ ਵਧੀਆ ਕੰਮ ਕਰਨਾ ਕਿਉਂਕੀ ਵਾਰ ਵਾਰ ਇਹ ਮੌਕਾ ਨਹੀਂ ਆਉਂਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਐਡਵਾਂਸ ਤਾਂ ਦੇਦਾਂਗੇ ਹਾਂਜੀ ਹਾਂਜੀ ਕੋਈ ਨਹੀਂ ਤੁਹਾਨੂੰ ਸਾਰੇ ਫੰਕਸ਼ਨ ਦੀ ਤਰੀਕ ਵੀ ਨੋਟ ਕਰਵਾ ਦਾਂਗੇ ਐਡਵਾਂਸ ਵੀ ਦੇ ਦਾਂਗੇ ਫਿਰ ਹਾਂਜੀ ਹਾਂਜੀ ਠੀਕ ਹ ਜੀ ਕੋਈ ਦਿੱਕਤ ਨਹੀਂ ਅਸੀਂ ਸ਼ਾਮ ਤੱਕ ਹੀ ਪਹੁੰਚਦੇ ਆ ਤੁਹਾਡੇ ਕੋਲ ਹਾਂਜੀ ਠੀਕ ਹ ਜੀ ਧੰਨਵਾਦ ਜੀ